ਸਾਡੇ ਇਲਾਕੇ ਵਿੱਚ ਕਈ ਸਾਰੇ ਅਜਿਹੇ ਥਾਂ ਹੈ ਜੋ ਸਾਡੇ ਸੱਭਿਆਚਾਰ ਨਾਲ ਅਤੇ ਧਾਰਮਿਕ ਨਾਲ ਧਾਰ ਧਰਮ ਨਾਲ ਜੁੜਿਆ ਹੈ ਅਤੇ ਉਸਦੀ ਬਹੁਤ ਹੀ ਜ਼ਿਆਦਾ ਮਹੱਤਵ ਹੈ ਉਹਨਾਂ ਵਿੱਚ ਇੱਕ ਹੈ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਸਾਡੇ ਧਰਮ ਨਾਲ ਜੁੜਿਆ ਹੈ ਇਹ ਅਤੇ ਸਾਡੇ ਸੱਭਿਆਚਾਰ ਨੂੰ ਵੀ ਦਰਸਾਉਂਦਾ ਹੈ ਹਰਿਮੰਦਰ ਸਾਹਿਬ ਸਾਡੇ ਗੁਰੂਆਂ ਨਾਲ ਜੁੜਿਆ ਹੋਇਆ ਹੈ ਦੱਸਦਾ ਹੈ ਕਿ ਕਿਸ ਤਰ੍ਹਾਂ ਗੁਰੂਆਂ ਨੇ ਸਾਡੇ ਵਾਸਤੇ ਆਪਣੇ ਜੀਵਨ ਨੂੰ ਕੁਰਬਾਨ ਕੀਤਾ ਹੈ ਅਤੇ ਹੋਰ ਵੀ ਕੁਝ ਹੋਰ ਵੀ ਕਿੰਨਾ ਕੁਝ ਦੱਸਦੇ ਨੇ ਮੈਨੂੰ ਇੱਥੇ ਜਾਣਾ ਬਹੁਤ ਪਸੰਦ ਹੈ ਅਤੇ ਮੈਂ ਪੰਜ ਕ ਛੇ ਵਾਰ ਇਸ ਜਗ੍ਹਾ ਤੋਂ ਹਰਿਮੰਦਰ ਸਾਹਿਬ ਤੋਂ ਹੋ ਆਈ ਹਾਂ ਧੰਨਵਾਦ